ਹੈਲੋ ਹੈਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਏ ਦੀਦੀ ਮੈਂ ਨਾ ਨਿਊ ਮਤਲਬ ਦਿੱਲੀ ਤੋਂ ਆਏ ਸੀਗੇ ਇਥੇ ਤੁਹਾਡੇ ਆਲ ਤੁਹਾਡੇ ਇਥੇ ਗੁਆਂਢ 'ਚ ਅਤੇ ਮੈਨੂੰ ਤੁਹਾਡਾ ਨੰਬਰ ਹੈ ਨਾ ਮਨੀਸ਼ਾ ਤੋਂ ਮਿਲਿਆ ਸੀਗਾ ਹਾਂਜੀ ਮੈਂ ਤੁਹਾਡੇ ਇਧਰ ਇਲਾਕੇ ਵਿੱਚ ਨਵੀਂ ਹਾਂ ਅਤੇ ਮੈਨੂੰ ਨਾ ਮਤਲਬ ਇਹ ਪੁੱਛਣਾ ਸੀ ਮਤਲਬ ਵਧੀਆ ਰੈਸਟੋਰੈਂਟ ਕਿਹੜਾ ਆ ਹਾਂਜੀ ਓਕੇ ਠੀਕ ਏ ਓਕੇ ਅਤੇ ਮੈਂ ਇਹ ਪੁੱਛਣਾ ਸੀ ਵੀ ਮੈਂ ਕੀ ਮੈਂ ਨੋਨ ਵੈਜ ਤਾਂ ਮੈਂ ਖਾਂਦੀ ਨਹੀਂ ਹੈਗੀ ਹੈ ਨਾ ਅਤੇ ਮੈਨੂੰ ਨਾ ਮਤਲਬ ਉਥੇ ਵੈਜ ਹੀ ਬਣਾਉਂਦੇ ਆ ਠੀਕ ਹੈ ਅਤੇ ਠੀਕ ਹੈ ਅਤੇ ਦੀਦੀ ਉਥੇ ਮਤਲਬ ਕਿ ਸਫਾਈ ਵਗੈਰਾ ਦਾ ਕਿਵੇਂ ਆ ਮਤਲਬ ਸਫਾਈ ਵਗੈਰਾ ਸਹੀ ਠੀਕ ਹੈ ਅਤੇ ਉਹ ਅਤੇ ਦੀਦੀ ਮਤਲਬ ਉਹਨਾਂ ਦਾ ਜਿੱਦਾ ਮਤਲਬ ਮਤਲਬ ਕਿਵੇਂ ਦਾ ਹੁੰਦਾ ਉਹਨਾਂ ਦਾ ਖਾਣਾ ਸਫਾਈ ਸਫੁਈ ਦਾ ਕਿੰਨੇ ਦਾ ਹੁੰਦਾ ਠੀਕ ਰਹਿੰਦਾ ਠੀਕ ਹੈ ਹਾਂਜੀ ਠੀਕ ਏ ਅਤੇ ਹਾਂਜੀ ਜੀ ਹਾਂਜੀ ਦੀਦੀ ਤੁਹਾਨੂੰ ਮਤਲਬ ਜਿੱਦਾਂ ਜਿੱਦਾਂ ਰੈਂਟ ਵਗੈਰਾ ਹੁੰਦਾ ਆ ਮਤਲਬ ਇੱਕ ਵਨ ਡੇ ਦਾ ਰੈ ਵਨ ਨਾਈਟ ਦਾ ਰੈਂਟ ਵਗੈਰਾ ਕਿੰਨਾ ਇਥੇ ਠੀਕ ਹੈ ਠੀਕ ਹੈ ਦੀਦੀ ਥੈਂਕ ਯੂ ਸੋ ਮਚ ਤੁਸੀਂ ਮੇਰੀ ਇੰਨੀ ਹੈਲਪ ਕੀਤੀ ਠੀਕ ਹੈ ਦੀਦੀ ਥੈਂਕ ਯੂ ਸੋ ਮਚ